ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਤੁਸੀਂ ਸੁਣਾਓ ਹਾਂਜੀ ਹੋਰ ਸੁਣਾਓ ਕੀ ਕਰਦੇ ਬੱਚੇ ਹਾਂਜੀ ਹਾਂ ਤੁਸੀਂ ਆਪਣੇ ਬੱਚੇ ਨੂੰ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਪਾ ਲਉ ਮੈਂ ਆ ਮੈਂ ਆਪਣੇ ਬੱਚੇ ਪਾ ਰਹੀ ਹਾਂ ਹਾਂਜੀ ਮੈਂ ਉੱਥੇ ਕਿਉਂਕਿ ਓਨਾਂ ਵਧੀਆ ਉਹਨਾਂ ਨੂੰ ਮਿਲਦਾ ਨਹੀ ਪਿਆ ਮਾਹੌਲ ਤਾਂ ਕਰਕੇ ਮੈਂ ਵੀ ਆਪਣੇ ਬੱਚੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਠੀਕ ਠਾਕ ਹਾਂਜੀ ਆਪਾਂ ਮਿਲ ਕੇ ਅਸੀਂ ਕੋਲਜ ਸਕੂਲ ਦਾ ਪਤਾ ਕਰਦੇ ਹਾਂ ਵੀ ਕੀ ਹਾਂਜੀ ਕੀ ਓਪਰਚੁਨਿਟੀਜ਼ ਨੇ ਮਤਲਬ ਕਿੱਦਾਂ ਸਾਰਾ ਕੁਛ ਪਤਾ ਕਰਦੇ ਹਾਂ

ਓਕੇ